ਮੇਰਾ ਸਭ ਤੋਂ ਉੱਚਾ ਰਿਕਾਰਡ ਦੋ ਮਿੰਟ ਵਿੱਚ ਦੋ ਸੌ ਕਿਲੋਮੀਟਰ ਦੌੜਨਾ ਹੈ ਮੈਂ ਹਰ ਰੋਜ਼ ਵੀਹ ਮਿੰਟ ਲਈ ਦੌੜ ਦੌੜਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਮੈਂ ਰਨਿੰਗ ਦੇ ਵਿੱਚ ਇੱਕ ਚੰਗਾ ਰਿਕਾਰਡ ਬਣਾਵਾਂ ਅਤੇ ਦੋ ਹਜ਼ਾਰ ਮੀਟਰ ਦੀ ਦੌੜ ਨੂੰ ਪੰਜ ਮਿੰਟ ਵਿੱਚ ਪੂਰਾ ਕਰਾਂ